ਫਾਜਿਲਕਾ ਸ਼ੇਤਰ ਵਿੱਚ ਕਈ ਤਰ੍ਹਾਂ ਦੇ ਸਕੂਲ ਤੇ ਕਾਲਜ ਨੇ ਜਿਵੇਂ ਪ੍ਰਾਈਵੇਟ ਸਰਕਾਰੀ ਸਕੂਲ ਤੇ ਇਹਨਾਂ ਵਿੱਚ ਸਿਖਲਾਈ ਬੱਚਿਆਂ ਨੂੰ ਤੇ ਸਕੂਲਾਂ ਵਿੱਚ ਸਿਖਾਈ ਪੜਾਈ ਸਿਖਲਾਈ ਕਰਾਈ ਜਾ ਰਹੀ ਹੈ ਤੇ ਕਾਲਜਾਂ ਵਿੱਚ ਫਾਈਨ ਆਰਟਸ ਦਾ ਕੰਮ ਵੀ ਕਰਾ ਰਹੇ ਨੇ ਇਹਨਾਂ ਦੇ ਰਿਲੇਟਡ ਜਿਵੇਂ ਅੱਗੇ ਬੱਚਿਆਂ ਨੂੰ ਫਾਈਨ ਆਟਸ ਦਾ ਕੰਮ ਜਾਂ ਚਿੱਤਰਕਾਰੀ ਕਲਾ ਸਿਖਾਈ ਜਾ ਰਹੀ ਹੈ ਸੋ ਇਨਾਂ ਵੱਖ ਵੱਖ ਸਕੂਲ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਕਾਫੀ ਅੱਛੀ ਸਿਖਲਾਈ ਦੇਣ ਵਾਸਤੇ ਹਰ ਤਰ੍ਹਾਂ ਦੇ ਟੀਚਰ ਮੁਹਈਆ ਕਰਵਾਏ ਜਾਂਦੇ ਨੇ ਤੇ ਹਰ ਤਰ੍ਹਾਂ ਦੇ ਟੀਚਰ ਰੱਖੇ ਜਾਂਦੇ ਨੇ